ਪਾਣੀ ਇੱਕ ਵਢਮੁੱਲੀ ਦਾਤ ਹੈ ਇਸ ਨੂੰ ਕੁਦਰਤ ਨੇ ਸਾਜਿਆ ਹੈ ਇਸ ਨੂੰ ਫਿਲਟਰ ਕਰਨ ਲਈ ਲੋਕ ਅਨੇਕਾਂ ਵਿਧੀਆਂ ਦਾ ਯੂਜ਼ ਕਰਦੇ ਹਨ ਜਿਸ ਤਰ੍ਹਾਂ ਕੋਈ ਫਿਲਟਰ ਲਗਵਾਉਂਦਾ ਹੈ ਘਰਾਂ ਵਿੱਚ ਇਲੈਕਟ੍ਰਾਨਿਕ ਫਿਲਟਰ ਜਿਵੇਂ ਕਿ ਕੁਛ ਸਧਾਰਨ ਤੌਰ 'ਤੇ ਘਰੈਲੂ ਫਿਲਟਰ ਆ ਜਾਂਦੇ ਜਿਵੇਂ ਘੜੇ ਵਿੱਚ ਪਾਣੀ ਰੱਖ ਦਿੰਦੇ ਹਨ ਉਹ ਹੌਲੀ ਹੌਲੀ ਠੰਡਾ ਵੀ ਹੁੰਦਾ ਅਤੇ ਸ਼ੁੱਧ ਵੀ ਹੋ ਜਾਂਦਾ ਉਸਨੂੰ ਹਵਾ ਨਾਲ ਹੀ ਘੜੇ ਦੇ ਵਿੱਚ ਪਾਣੀ ਠੰਡਾ ਹੁੰਦਾ ਜਾਂਦਾ ਹੈ ਅਤੇ ਕੁਝ ਘਰੇਲੂ ਨੁਸਖੇ ਹੋਰ ਵੀ ਹਨ ਅਨੇਕਾਂ ਪ੍ਰਕਾਰ ਦੇ ਜਿਨ੍ਹਾਂ ਨਾਲ ਪਾਣੀ ਨੂੰ ਫਿਲਟਰ ਕੀਤਾ ਜਾਂਦਾ ਹੈ ਪਾਣੀ ਇੱਕ ਨੂੰ ਹਰੇਕ ਬੰਦੇ ਨੂੰ ਫਿਲਟਰ ਕਰਕੇ ਪੀਣਾ ਚਾਹੀਦਾ ਹੈ